ਜੇਕਰ ਅਸੀਂ ਭੰਗੜੇ ਦੀ ਗੱਲ ਕਰੀਏ ਤਾਂ ਇਸਦਾ ਪੰਜਾਬੀ ਸੱਭਿਆਚਾਰ ਉੱਤੇ ਬਹੁਤ ਵੱਡਾ ਯੋਗਦਾਨ ਹੈ ਕਿਉਂਕਿ ਅਸੀਂ ਜਦੋਂ ਵੀ ਕਿਸੇ ਖੁਸ਼ੀ ਵਾਲੇ ਸਮੇਂ 'ਤੇ ਵਿਸਾਖੀ ਵੇਲੇ ਤਿਉਹਾਰ ਵੇਲੇ ਵਿਆਹ ਵੇਲੇ ਉਸ ਸਮੇਂ ਅਸੀਂ ਭੰਗੜਾ ਕਰਦੇ ਹਾਂ ਤਾਂ ਇਸ ਤਰ੍ਹਾਂ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਮਿਲਦੀ ਹੈ ਸੋ ਸਾਡੇ ਜੀਵਨ ਦੇ ਵਿੱਚ ਪੰਜਾਬੀ ਸੱਭਿਆ ਵਿੱਚ ਸੱਭਿਆਚਾਰ ਵਿੱਚ ਭੰਗੜੇ ਦੀ ਬਹੁਤ ਵੱਡੀ ਮਹੱਤਤਾ ਹੈ ਥੈਂਕ ਯੂ